ਜਿਵੇਂ ਕਿ ਮੈਨੂੰ ਘੁੰਮਣਾ ਬਹੁਤ ਪਸੰਦ ਹੈ ਮੈਂ ਠੰਡੇ ਮਿੱਠੇ ਮੋਸਮ ਵਿੱਚ ਹੀ ਘਰੋਂ ਬਾਹਰ ਨਿਕਲਨਾ ਪਸੰਦ ਕਰਦੀ ਹਾਂ ਕਿ ਉਦੋਂ ਨਾ ਤਾਂ ਬਹੁਤ ਗਰਮੀ ਹੁੰਦੀ ਹੈ ਜਦਕਿ ਉਸ ਮੋਸਮ ਵਿੱਚ ਨਾ ਤਾਂ ਬਹੁਤ ਹੀ ਗਰਮੀ ਹੁੰਦੀ ਹੈ ਅਤੇ ਨਾ ਬਹੁਤ ਸਰਦੀ ਹੁੰਦੀ ਹੈ ਠੰਡਾ ਮਿੱਠਾ ਜਾ ਮੋਸਮ ਹੁੰਦਾ ਸੁਹਾਵਣੀ ਹਵਾ ਸੁਹਾਵਣਾ ਮੋਸਮ ਸਾਰੇ ਬੰਨੇ ਦ੍ਰਿਸ਼ ਸੁੰਦਰ ਸੁੰਦਰ ਹੁੰਦੇ ਨੇ ਮੈਂ ਉਦੋਂ ਵੀ ਇਕੱਠੀਆਂ ਛੁੱਟੀਆਂ ਲੈ ਕੇ ਮੈਂ ਹਿਮਾਚਲ ਵਾਲੀ ਸਾਈਡ 'ਤੇ ਵੀ ਘੁੰਮਣ ਜਾ ਸਕਦੀ ਹਾਂ ਪਹਾੜਾਂ 'ਚ ਇੰਨਜੋਏ ਕਰ ਸਕਦੀ ਹਾਂ ਨਾ ਕਿ ਪਸੀਨੇ ਨਾਲ ਚਿੱਪ ਚਿੱਪ ਵਾਲੀ ਗਰਮੀ ਅਤੇ ਨਾ ਹੀ ਠੰਡ ਬਹੁਤ ਕੋਰੇ ਵਾਲੀ ਅਤੇ ਨਾ ਮੈਨੂੰ ਬਹੁਤਾ ਸਮਾਨ ਕੈਰੀ ਕਰਨਾ ਪੈਂਦਾ ਆ ਮੈਂ ਓਹ ਨੋ ਨੋਰਮਲ ਆਪਣੇ ਇੰਨਜੋਏ ਕਰ ਸਕਦੀ ਹਾਂ ਹਰ ਚੀਜ਼ ਨੂੰ ਸੁਹਾਵਣੇ ਦ੍ਰਿਸ਼ ਇੰਨਜੋਏ ਕਰ ਸਕਦੀ ਹਾਂ ਆਪਣੇ ਮਨ ਪਸੰਦੀਦਾ ਜਗ੍ਹਾ 'ਤੇ ਜਾ ਸਕਦੀ ਹਾਂ ਮੈਂ ਹਮੇਸ਼ਾਂ ਠੰਡੇ ਮਿੱਠੇ ਮੋਸਮ ਵਿੱਚ ਹੀ ਘੁੰਮਣ ਜਾਣਾ ਪਸੰਦ ਕਰਦੀ ਹਾਂ ਮੈਂ ਹਿਮਾਚਲ ਵਾਲੀ ਸਾਈਡ 'ਤੇ ਜਾਂਦੀ ਹਾਂ ਪਹਾੜਾਂ ਦਾ ਆਨੰਦ ਮਾਣਦੀ ਹਾਂ ਹਵਾਵਾਂ ਸੁੰਦਰ ਸੁੰਦਰ ਹਵਾਵਾਂ ਪੰਛੀ ਜੀਵ ਜੰਤੂ ਸਾਰੇ ਐਨੀਮਲਸ ਜਾਨਵਰ ਸਾਰਾ ਕੁਛ ਵੇਖਣਾ ਪਸੰਦ ਕਰਦੀ ਹਾਂ ਮੈਨੂੰ ਘੁੰਮਣ ਜਾਣ 'ਤੇ ਇੱਕ ਇੱਕ ਅਲੱਗ ਹੀ ਰਿਲੈਕਸੇਸ਼ਨ ਮਿਲਦੀ ਹੈ ਇੱਕ ਵੱਖਰੀ ਸ਼ਾਂਤੀ ਮਿਲਦੀ ਹੈ ਮਨ ਨੂੰ ਬਹੁਤ ਅੱਛਾ ਲੱਗਦਾ ਮੈਨੂੰ ਘੁੰਮਣਾ ਠੰਡੇ ਮਿੱਠੇ ਮੋਸਮ ਵਿੱਚ